ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਇਸ਼ੂ ਆ ਸਕਦਾ ਇਸ ਚੀਜ਼ ਦੇ ਵਿੱਚ ਤਾਂ ਕਿਸੇ ਡਾਕਟਰ ਦੀ ਜਾਂ ਕਿਸੇ ਹੋਰ ਦੀ ਮਦਦ ਵੀ ਲੈ ਸਕਦੇ ਹੋ ਤੁਸੀਂ ਮੈਂ ਤਾਂ ਨੋਰਮਲ ਘਰ 'ਚ ਬੜੇ ਫਾਰਮੂਲੇ ਹੁੰਦੇ ਨੇ ਸਾਫ਼ ਸੁਥਰਾ ਪਾਣੀ ਪੀਓ ਠੀਕ ਹੈ ਨਾ ਸਾਫ਼ ਸੁਥਰਾ ਪਾਣੀ ਪੀਓ ਅਤੇ ਉਹ ਗਰਾਰੇ ਸ਼ਰਾਰੇ ਜਿਹੜੇ ਹੁੰਦੇ ਆ ਜਿੱਦਾਂ ਗਰਾਰੇ ਕਰੀਦੇ ਆ ਨਮਕ ਪਾ ਕੇ ਜਾਂ ਕੁਛ ਇੱਦਾਂ ਦੀਆਂ ਕੁਛ ਕੋਈ ਵੀ ਅ ਮਾਈਨਰ ਜਿਹੇ ਹੁੰਦੇ ਆ ਉਹਨਾਂ ਚੀਜ਼ਾਂ ਦਾ ਉਹਨਾਂ ਚੀਜ਼ਾਂ ਨਾਲ ਆਪਣੇ ਗਲੇ ਨੂੰ ਤਰੋ ਤਾਜ਼ਾ ਰੱਖੋ ਥੋੜ੍ਹਾ ਗੁਣਗੁਣਾ ਕਰਕੇ ਪਾਣੀ ਪੀਓ ਗਲੇ ਨੂੰ ਨਮੀਂਦਾਰ ਰੱਖੋ ਨੱਕ ਨਾਲ ਸਟੀਮ ਲੈ ਕੇ ਵੀ ਤੁਸੀਂ ਆਪਣੇ ਗਲੇ ਨੂੰ ਗਰਮ ਰੱਖ ਸਕਦੇ ਹੋ ਠੀਕ ਹੈ ਨਾ ਕੋਈ ਜਿਵੇਂ ਕੋਫੀ ਕੁਫੀਆ ਹੁੰਦੀਆਂ ਨੇ ਕਾਫੀ ਹੋ ਗਈ ਚਾਹ ਹੋ ਗਈ ਅਲਕੋਹਲ ਦੀ ਵਰਤੋਂ ਘੱਟ ਕਰੋ ਕੋਈ ਜਿਵੇਂ ਤੁਸੀਂ ਆ ਖਾ ਲੈਂਦੇ ਹੋ ਰੋ ਫਰਾਈਡ ਚੀਜ਼ਾਂ ਇਹਨਾਂ ਚੀਜ਼ਾਂ ਦੀ ਘੱਟ ਕਰੋ ਆਪਣੀ ਸਹਿਜ ਸੁਭਾਅ ਨਾਲ ਬੋਲ ਕੇ ਆਪਣਾ ਚਲਦੇ ਰਹੋ ਹੋਰ ਕੀ ਹੈ ਇਹਦੇ ਵਿੱਚ ਕੋਈ ਇੰਨੀ ਉਹ ਨਹੀਂ ਹੈ ਪਰ ਗਲੇ ਨੂੰ ਠੀਕ ਰੱਖੋ ਅਗਰ ਠੰਡਾ ਮੌਸਮ ਤਾਂ ਨੱਕ ਨੂੰ ਢੱਕ ਕੇ ਰੱਖੋ ਬਾਹਰ ਘੱਟ ਨਿਕਲੋ ਆਪਣੇ ਛਾਤੀ ਨੂੰ ਕਵਰ ਕਰਕੇ ਰੱਖੋ ਸੋਫਟ ਤਰੀਕੇ ਨਾਲ ਬੋਲੋ ਉੱਚੀ ਮਤਲਬ ਨਾ ਬੋਲੋ ਚੀਕਾਂ ਨਾ ਮਾਰੋ ਭਾਰੀ ਆਵਾਜ਼ ਨਾਲ ਮਤਲਬ ਤੁਹਾਨੂੰ ਕੋਈ ਇੰਨੀ ਉਹ ਨਹੀਂ ਹੋਣੀ ਚਾਹੀਦੀ ਨੋਰਮਲ ਪ੍ਰੈਕਟਿਸ ਰੱਖੋ ਕੋਈ ਜ਼ਿਆਦਾ ਗਲੇ ਨੂੰ ਇੱਕਦਮ ਨਾ ਤੰਗ ਕਰੋ ਇਹ ਹੀ ਚੀਜ਼ਾਂ ਨੇ ਗੁਣਗਣੇ ਪਾਣੀ ਦੀ ਵਰਤੋਂ ਹਾਂ ਜੇ ਨਹੀਂ ਇਹਨਾਂ ਚੀਜ਼ਾਂ ਨਾਲ ਤੁਹਾਨੂੰ ਘਰੇਲੂ ਨੁਸਖੇ ਨਾਲ ਕੋਈ ਫ਼ਰਕ ਪੈ ਰਿਹਾ ਤਾਂ ਤੁਸੀਂ ਕਿਸੇ ਪ੍ਰੋਫੈਸ਼ਨਲ ਦੀ ਮਦਦ ਲੈ ਲਓ ਨਾ ਜਿਵੇਂ ਡਾਕਟਰ ਹੋ ਗਿਆ ਜਾਂ ਕੋਈ ਵੈਦ ਹਕੀਮ ਹੋ ਗਿਆ ਜਿਵੇਂ ਪੁਰਾਣੇ ਟਾਈਮਾਂ ਤੋਂ ਚੱਲ ਰਹੇ ਸੀ ਇਹਨਾਂ ਚੀਜ਼ਾਂ ਲਈ ਮਤਲਬ ਉਹਨਾਂ ਨੂੰ ਤੁਹਾਡੇ ਅੱਛਾ ਆਪਾਂ ਪਹਿਲਾਂ ਗੱਲ ਕੀਤੀ ਅਧਿਆਪਕ ਦੀ ਤਾਂ ਤੁਸੀਂ ਇਹਨਾਂ ਚੀਜ਼ਾਂ ਦੀ ਅਧਿਆਪਕ ਤੋਂ ਵੀ ਸਲਾਹ ਲੈ ਸਕਦੇ ਹੋ ਬੜੀ ਵਧੀਆ ਗਾਈਡੈਂਸ ਕਿਉਂਕਿ ਉਹਨਾਂ ਨੂੰ ਪ੍ਰੈਕਟਿਸ ਹੋ ਜਾਂਦੀ ਆ ਉਹਨਾਂ ਦਾ ਤਜ਼ੁਰਬਾ ਬਣ ਜਾਂਦਾ ਹਾਂ ਪਲੀਜ਼